ਪੰਜਾਬ ਦੇ ਪਿੰਡਾਂ ਵਿੱਚ ਜਿਹੜੇ ਮੁੱਖ ਤੌਰ 'ਤੇ ਘਰ ਹੁੰਦੇ ਆ ਉਹ ਪੂਰੀ ਤਰ੍ਹਾਂ ਖੁੱਲ੍ਹੇ ਡੁੱਲੇ ਬਣਾਏ ਵੇ ਹੁੰਦੇ ਆ ਲੋਕਾਂ ਦੇ ਉਹਨਾਂ ਵਿੱਚ ਇੱਕ ਸਵਾਤ ਜਵ ਜ਼ਰੂਰੀ ਹੁੰਦੀ ਹੈ ਸਾਰੇ ਘਰਾਂ ਵਿੱਚ ਜਿਸ ਵਿੱਚ ਘਰ ਦੀਆਂ ਜਿਹੜੀਆਂ ਸੁਆਣੀਆਂ ਹੁੰਦੀਆਂ ਉਹਨਾਂ ਦੇ ਪੇਟੀਆਂ ਵਗੈਰਾ ਰੱਖੀਆਂ ਜਾਂਦੀਆਂ ਹਨ ਔਰ ਬੈਠਕਾਂ ਹੁੰਦੀ ਹੈ ਜਿਹੜੀ ਬੈਠਕ ਬਣਾਈ ਹੁੰਦੀ ਹੈ ਉਹ ਜ਼ਿਆਦਾਤਰ ਮੁੱਖ ਦੁਆਰ ਦੇ ਕੋਲੇ ਹੁੰਦੇ ਆ ਜਿੱਥੇ ਕਿ ਬਾਹਰੋਂ ਆਏ ਗਏ ਲੋਕਾਂ ਨੂੰ ਬਿਠਾਇਆ ਜਾਂਦਾ ਹੈ ਪਰ ਪਰਿਵਾਰ ਵਾਸਤੇ ਪਿੱਛੇ ਮਤਲਬ ਸੁਹਾਤਾਂ ਦੇ ਨਾਲ ਨਾਲ ਮੂਹਰੇ ਵਰਾਂਡੇ ਬਣੇ ਵੇ ਹੁੰਦੇ ਹਨ ਅਤੇ ਰਸੋਈ ਜਿਹੜੀ ਹੁੰਦੀ ਹੈ ਉਹਦੇ ਬਾਹਰਲੇ ਪਾਸੇ ਇੱਕ ਚੌਤਰਾ ਜਾਂ ਆਪਾਂ ਉਸਨੂੰ ਕਹਿੰਦੇ ਹਾਂ ਖੁੱਲ੍ਹੀ ਰਸੋਈ ਜ਼ਰੂਰ ਬਣੀ ਹੋਈ ਅਤੇ ਜਿੱਥੇ ਚੁੱਲ੍ਹਾ ਵਗੈਰਾ ਬਣਾਇਆ ਜਾਂਦਾ ਹੈ ਅਤੇ ਇੱਕ ਆਪਣੇ ਹਾਰੇ ਬਣਾਏ ਜਾਂਦਾ ਜਿਹਨਾਂ ਵਿੱਚ ਆਪਣੀ ਮੱਝਾਂ ਗਾਈਆਂ ਜੋ ਪਿੰਡਾਂ ਵਿੱਚ ਘਰਾਂ ਵਿੱਚ ਰੱਖੀਆਂ ਜਾਂਦੀਆਂ ਦੁੱਧ ਵਗੈਰਾ ਗਰਮ ਕਰਨ ਵਾਸਤੇ ਹਾਰੇ ਜ਼ਰੂਰ ਬਣਾਏ ਵੇ ਹੁੰਦੇ ਹਨ ਘਰਾਂ ਵਿੱਚ ਖੁੱਲ੍ਹੇ ਡੁੱਲੇ ਹੋਣ ਦੇ ਕਾਰਨ ਪਸ਼ੂਆਂ ਨੂੰ ਰੱਖਣ ਵਾਸਤੇ ਵੀ ਮਤਲਬ ਦੇਖੋ ਕਾਫੀ ਬਣਾਉਣਾ ਪੈਂਦਾ ਉਹਨੂੰ ਕਈ ਪਿੰਡਾਂ ਵਿੱਚ ਉਹਨਾਂ ਨੂੰ ਬਾਹਰਲਾ ਘਰ ਕਹਿੰਦੇ ਹੈ ਜਿੱਥੇ ਉਹ ਪਸ਼ੂਆਂ ਵਾਸਤੇ ਅਲੱਗ ਜਗ੍ਹਾ ਰੱਖਦੇ ਹੈ ਉਹਨਾਂ ਨੂੰ ਬੰਨ੍ਹਣ ਵਗੈਰਾ ਵਾਸਤੇ ਸੰਭਾਲਣ ਵਾਸਤੇ ਅਤੇ ਉਹ ਤੂੜੀ ਵਾਲਾ ਘਰ ਵੀ ਇੱਕ ਉੱਥੇ ਵੱਡਾ ਸਾਰਾ ਕਮਰਾ ਬਣਾਇਆ ਜਾਂਦਾ ਜਿਸ ਨੂੰ ਤੂੜੀ ਵਾਲਾ ਕਹਿੰਦੇ ਹੈ ਜਿਸ ਵਿੱਚ ਮੱਝਾਂ ਗਾਈਆਂ ਵਾਸਤੇ ਆਪਾਂ ਸਾਲ ਭਰ ਦੀ ਤੂੜੀ ਸੰਭਾਲ ਕੇ ਰੱਖਦੇ ਹਾਂ ਔਰ ਪਿੰਡਾਂ ਵਰਗੇ ਘਰ ਵੀ ਸ਼ਹਿਰਾਂ ਵਿੱਚ ਨਹੀਂ ਹੋ ਸਕਦੇ ਨਾ ਹੀ ਪਿੰਡਾਂ ਦੇ ਲੋਕ ਸ਼ਹਿਰਾਂ ਵਿੱਚ ਆ ਕੇ ਰਹਿਣਾ ਬਹੁਤ ਘੱਟ ਪਸੰਦ ਕਰਦੇ ਕਿਉਂਕਿ ਉਹਨੂੰ ਖੁੱਲ੍ਹੇ ਡੁੱਲੇ ਘਰਾਂ ਵਿੱਚ ਰਹਿਣ ਦੀ ਆਦਤ ਹੁੰਦੀ ਹੈਗੀ ਉਹਨਾਂ ਦੇ ਘਰਾਂ ਵਿੱਚ ਦਰੱਖਤ ਜ਼ਰੂਰ ਹੁੰਦੇ ਹੈਗੇ ਜਿਹਦੀ ਛਾਵੇਂ ਉਹ ਆਪਣੇ ਗਰਮੀਆਂ ਦੇ ਦੁਪਹਿਰੇ ਬਹੁਤ ਵਧੀਆ ਕੱਟਦੇ ਹਨ ਇਸ ਲਈ ਪਿੰ ਪਿੰਡਾਂ ਦੇ ਘਰ ਹੈ ਜਿਹੜੇ ਉਹ ਸ਼ਹਿਰਾਂ ਨਾਲੋਂ ਵੱਖਰੇ ਹੁੰਦੇ ਹਨ ਅਤੇ ਬਹੁਤ ਵਧੀਆ ਵੀ ਹੁੰਦੇ ਹਨ